ਮੋਹਾਲੀ ਜ਼ਿਲ੍ਹੇ ਵਿੱਚ ਖੇਤੀਬਾੜੀ ਉਪਾਦ ਕਈ ਹਨ ਜਿਵੇਂ ਕਣਕ ਮੱਕੀ ਕਮਾਦ ਜ਼ੀਰੀ ਆਲੂ ਦਾਲ਼ਾਂ ਕਣਕ ਨਵੰਬਰ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਇਹ ਅਪ੍ਰੈਲ ਦੇ ਵਿੱਚ ਵੱਢੀ ਜਾਂਦੀ ਹੈ ਅਤੇ ਕਣਕ ਜਦੋਂ ਮਸ਼ੀਨਾਂ ਰਾਹੀਂ ਕਢਵਾ ਦਿੰਦੇ ਬਾਅਦ 'ਚ ਉਹਦੀ ਤੂੜੀ ਬਣਦੀ ਹੈ ਉਹਦੇ ਫੂਸ ਦੀ ਅਤੇ ਉਹ ਫਿਰ ਮੱਝਾਂ ਨੂੰ ਪੈਂਦੀ ਹੈ ਮੱਕੀ ਮੱਕੀ ਦਾ ਆਚਾਰ ਵੀ ਬਣਦਾ ਹੈ ਮੱਕੀ ਕਢਾਈ ਵੀ ਜਾਂਦੀ ਹੈ ਅਤੇ ਮੱਕੀ ਦਾ ਆਟਾ ਵੀ ਬਣਦਾ ਹੈ ਜੀ ਕਮਾਦ ਕਮਾਦ ਇੱਕ ਸਾਲ ਲੈਂਦਾ ਹੈ ਕਮਾਦ ਨਾਲ਼ ਚੀਨੀ ਬਣਦੀ ਹੈ ਅਤੇ ਜ਼ੀਰੀ ਜ਼ੀਰੀ ਆਪਣੇ ਚੌਲ਼ ਵਿਕਦੇ ਹਨ ਬੜੀਆ ਮੰਡੀਆਂ 'ਚ ਅਤੇ ਦਾਲ਼ਾਂ ਵੀ ਹੁੰਦੀਆਂ ਹਨ ਬਹੁਤੇ ਕਿਸਾਨ ਇੱਥੇ ਦਾਲ਼ਾਂ ਵੀ ਲਾਉਂਦੇ ਹਨ ਅਤੇ ਜਿਵੇਂ ਮੋਹਾਲੀ ਜ਼ਿਲ੍ਹੇ ਵਿੱਚ ਲੋਕਾਂ ਨੇ ਵਾਧੂ ਪਸ਼ੂ ਪਾਲਕ ਵੀ ਹਨ ਜਿਵੇਂ ਬੱਕਰੀਆਂ ਅਤੇ ਮੱਝਾਂ ਤੇ ਗਾਈਆਂ ਅਤੇ ਉਨ੍ਹਾਂ ਦਾ ਹਰਾ ਚਾਰਾ ਜਿਵੇਂ ਕਿ ਬਾਜਰਾ ਜਵੀਂ ਬਰਸੀਨ ਇਹ ਬਾਜਰਾ ਅਤੇ ਚਰ੍ਹੀ ਇਕੱਠੇ ਹੁੰਦੇ ਹਨ ਇਹ ਹੁੰਦੇ ਹਨ ਜੁਲਾਈ ਜੂਨ ਜੁਲਾਈ ਮਹੀਨੇ ਵਿੱਚ ਅਤੇ ਤਿੰਨ ਮਹੀਨੇ ਪੈਂਦੇ ਹਨ ਉਸ ਤੋਂ ਬਾਅਦ ਫਿਰ ਬਰਸੀਨ ਦੀ ਉਹ ਸ਼ੁਰੂ ਹੋ ਜਾਂਦੀ ਹੈ ਉਹ ਠੰਢਾਂ ਵਿੱਚ ਪਸ਼ੂਆਂ ਨੂੰ ਪੈਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਇੱਥੇ ਟੈਕਨੋਲਜੀ ਬਹੁਤ ਹਨ ਸਿੰਚਾਈ ਪਾਣੀ ਦੀ ਸਿੰਚਾਈ ਲਈ ਬੋਰ ਅਤੇ ਆਪਣੇ ਹੋਰ ਤਕਨੀਕਾਂ ਹਨ ਅਤੇ ਟਰੈਕਟਰ ਵੀ ਇੱਥੇ ਨਵੀਂ ਟਕਨੋਲਜ ਦੇ ਹਨ ਅਤੇ ਸੀਡਰ ਜਿਵੇਂ ਸੁਪਰ ਸੀਡਰ ਹੈ ਉਹ ਨਾਲ਼ ਦੀ ਨਾਲ਼ ਜਿਵੇਂ ਜ਼ੀਰੀ ਦਾ ਫੂਸ ਹੁੰਦਾ ਅਤੇ ਆਪਣਾ ਕਣਕ ਦਾ ਫੂਸ ਹੁੰਦਾ ਉਹਨੂੰ ਵਿ ਮਿੱਟੀ ਵਿੱਚ ਰਲ਼ਾ ਦਿੰਦਾ ਹੈ ਨਾਲ਼ ਦੀ ਨਾਲ਼ ਬਿਜਾਈ ਕਰ ਦਿੰਦਾ ਹੈ ਜਿਸ ਨਾਲ਼ ਪੋਲਿਊਸ਼ਨ ਨਹੀਂ ਹੁੰਦਾ ਅਤੇ ਕਿਸਾਨ ਇੱਥੇ ਆਪਣਾ ਫਾਇਦਾ ਉਹ ਇੱਕ ਤਰ੍ਹਾਂ ਤੋਂ ਖਾਦ ਦਾ ਕੰਮ ਵੀ ਕਰਦਾ ਹੈ